ਮੈਨੂੰ ਪ ਪੰਛੀਆਂ ਨੂੰ ਦੇਖਣ ਲਈ ਕੋਈ ਵੱਡੀ ਔਕੜ ਨਹੀਂ ਆਉਂਦੀ ਹੈ ਮੈਂ ਪੰਛੀਆਂ ਨੂੰ ਬਚਪਨ ਤੋਂ ਹੀ ਦੇਖ ਰਹੀ ਹਾਂ ਜਿਵੇਂ ਜਿਵੇਂ ਜਿਵੇਂ ਕਿ ਚਿੜੀਆਂ ਕਬੂਤਰ ਤੋਤੇ ਅਤੇ ਲਾਲੜੀਆਂ ਵਗੈਰਾ ਉੱਪਰ ਹੁੰਦੀਆਂ ਹੋਈਆਂ ਦੇਖਦੀ ਹਾਂ ਮੈਨੂੰ ਦੇਖ ਕੇ ਬੜਾ ਸਕੂਨ ਜਿਹਾ ਮਿਲਦਾ ਹੈ ਮੈਂ ਮੈਂ ਕਿਤੇ ਵੀ ਐਪਸ ਜਾਂ ਕੋਈ ਗਾਈਡ ਤੋਂ ਇਹਨਾਂ ਨੂੰ ਨਹੀਂ ਦੇਖਦੀ ਮੈਂ ਬਚਪਨ ਤੋਂ ਹੀ ਇਹਨਾਂ ਨਾਲ ਬੜਾ ਪਿਆਰ ਹੈ ਮੈਨੂੰ ਮੋ ਮੋਰ ਵੀ ਚੰਗਾ ਲੱਗਦਾ ਹੈ ਜਿਹੜਾ ਸਾਡਾ ਕਿ ਇਡ ਭਾਰਤ ਦਾ ਕ ਰਾਜਾ ਪੰਛੀ ਹੈ ਮੈਂ ਉਸ ਨੂੰ ਵੀ ਬੜਾ ਪਸੰਦ ਕਰਦੀ ਹਾਂ ਅਤੇ ਮੈਨੂੰ ਦੇਖਣ ਲੱਗਿਆ ਪਤਾ ਲੱਗ ਜਾਂਦਾ ਇਹ ਮੋਰ ਹੈ ਅਤੇ ਇਹ ਨੱਚਦਾ ਹੈ ਅਤੇ ਹੋਰ ਪੰਛੀ ਵੀ ਮੈਨੂੰ ਬੜੇ ਪਸੰਦ ਨੇ

ਜਿਹੜੇ ਕਿ ਪੰਜਾਬ ਪੰਜਾਬ ਵਿੱਚ ਨਹੀਂ ਦੇਖੇ ਦੇਖ ਪਾਉਂਦੇ ਜਿਹੜੇ ਅਸੀਂ ਬਾਹਰਲੇ ਦੇਸ਼ਾਂ ਵਿੱਚ ਵੀ ਦੇਖਦੇ ਹਾਂ ਇੱਥੇ ਤਾਂ ਚਿੜੀਆਂ ਕਾਂ ਤੋਤੇ ਅਤੇ ਕਬੂਤਰ ਹੀ ਦਿੱਖਦੇ ਹਨ ਲਾਲੜੀਆਂ ਵੀ ਦਿੱਖਦੀਆਂ ਹਨ ਅਤੇ ਉਹਨਾਂ ਨੂੰ ਦੇਖ ਕੇ ਮੈਂ ਬੜੀ ਹੀ ਖੁਸ਼ ਹੁੰਦੀ ਹਾਂ ਅਤੇ ਮੈਂ ਨਾ ਕੋਈ ਐਪਸ ਵਰਤੋਂ ਕੋਈ ਕੰਮ ਲੈਂਦੀ ਹਾਂ ਨਾ ਮੈਂ ਕੋਈ ਉੱਦਾਂ ਇਹ ਮੇਰੇ ਦਿਲ ਦੇ ਬੜੇ ਹੀ ਕਰੀਬ ਪੰਛੀ ਹੈ ਮੈਂ ਛੱਤ 'ਤੇ ਜਾ ਕੇ ਇਹਨਾਂ ਨੂੰ ਦੇਖ ਕੇ ਬੜੀ ਖੁਸ਼ ਹੁੰਦੀ ਹਾਂ ਅਤੇ ਬੜਾ ਹੀ ਓ ਪਿਆਰ ਨਾਲ ਇਹਨਾਂ ਨੂੰ ਲਾਡ ਨਾਲ ਦੇਖਦੀ ਹਾਂ ਧੰਨਵਾਦ